ਪੰਜਾਬ ਵਿੱਚ ਕਈ ਪ੍ਰਸਿੱਧ ਮਨੋਰੰਜਕ ਗਤੀਵਿਧੀਆਂ ਅਤੇ ਸਾਹੀ ਸਾਹ ਸਾਹਸੀ ਖੇਡਾਂ ਹਨ ਠੀਕ ਆ ਜਿਨ੍ਹਾਂ ਵਿੱਚ ਮਨੋਰੰਜਨ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕਈ ਤਰ੍ਹਾਂ ਦੇ ਅਜਿਹੇ ਅਜਿਹੇ ਡੈਮ ਹਨ ਜਿਨ੍ਹਾਂ 'ਤੇ ਜਿਨ੍ਹਾਂ ਵਿੱਚ ਜਾ ਕੇ ਬੰਦਾ ਆਪਣਾ ਮਨੋਰੰਜਨ ਕਰ ਸਕਦਾ ਹੈ ਉੱਥੇ ਬੋਟਿੰਗ ਕਰ ਸਕਦਾ ਹੈ ਠੀਕ ਹੈ ਉੱਥੇ ਜਾ ਕੇ ਪਿਕਨਿਕ ਮਨਾ ਸਕਦਾ ਹੈ ਅਤੇ ਹੋਰ ਤਰ੍ਹਾਂ ਦੀਆਂ ਕਈ ਕਈ ਸਹੂਲਤਾਂ ਹਨ ਜੋ ਕਿ ਵਿਅਕਤੀ ਆਪਣਾ ਮਨੋਰੰਜਨ ਕਰ ਸਕਦਾ ਹੈ ਠੀਕ ਹੈ ਅਤੇ ਸਾਹਸੀ ਖੇਡਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜ਼ਿਆਦਾਤਰ ਲੋਕ ਕਬੱਡੀ ਨੂੰ ਕਬੱਡੀ ਕਬੱਡੀ ਖੇਡਦੇ ਹਨ ਠੀਕ ਆ ਕਬੱਡੀ ਖੇਡਣ ਲਈ ਪੰਜਾਬ ਦੇ ਲੋਕ ਕਈ ਕਈ ਕ ਪੰਜਾਬ ਵਿੱਚ ਕਬੱਡੀ ਖੇਡਣ ਲਈ ਠੀਕ ਆ ਘੱਟੋ ਘੱਟ ਆਐਂ ਨੌ ਜਾਂ ਦਸ ਪਲੇਅਰ ਚਾਹੀਦੇ ਹੁੰਦੇ ਹਨ ਖਿਡਾਰੀ ਚਾਹੀਦੇ ਹੁੰਦੇ ਹਨ ਠੀਕ ਆ ਇਹ ਇੱਕ ਬਹੁਤ ਏ ਇਹ ਖੇਡ ਇੱਕ ਚੱਕਰ ਚੱਕਰ ਵਿੱਚ ਖੇਡੀ ਜਾਂਦੀ ਆਂ ਇਹਦੇ ਵਿੱਚ ਇੱਕ ਗੱਭੇ ਲਾਈਨ ਦਿੱਤੀ ਜਾਂਦੀ ਆਂ ਠੀਕ ਆ ਇਸ ਲਾਈਨ ਦੇ ਵਿੱਚ ਵੀ ਇੱਕ ਪੋਰਸ਼ਨ ਦਿੱਤਾ ਜਾਂਦਾ ਹੈ ਇੱਕ ਪਾਰਟ ਦਿੱਤਾ ਜਾਂਦਾ ਹੈ ਜਿਸ ਵਿੱਚ ਖਿਡਾਰੀ ਨਿਕਲਣਾ ਹੁੰਦਾ ਹੈ ਠੀਕ ਆ ਅਤੇ ਜਿਹੜੀ ਇੱਕ ਏ ਗ ਇਹਦੇ ਵਿੱਚ ਕਬੱਡੀ ਵਿੱਚ ਚਾਰ ਜਾਫੀ ਹੁੰਦੇ ਹਨ ਅਤੇ ਚਾਰ ਹੀ ਰੇਡਰ ਹੁੰਦੇ ਹਨ ਠੀਕ ਆ ਦੋ ਐਕਸਟ੍ਰਾ ਸਪੇਅਰ ਹੁੰਦੇ ਆ ਜੋ ਕਿ ਬਾਹਰ ਬੈਠੇ ਹੁੰਦੇ ਹਨ ਜਦੋਂ ਵੀ ਕਿਸੇ ਖਿਡਾਰੀ ਨੂੰ ਸੱਟ ਵੱਜ ਜਾਏ ਜਾਂ ਕੁਝ ਵੀ ਹੁੰਦਾ ਹੈ ਤਾਂ ਉਹ ਉਸ ਖਿਡਾਰੀ ਦੀ ਥਾਂ ਖੇਡਦੇ ਹਨ ਠੀਕ ਹੈ ਅਕਸਰ ਕਬੱਡੀ ਵਿੱਚ ਚਾਰ ਪ ਚਾਰ ਰੇਡਰ ਅਤੇ ਚਾਰ ਜਾਫੀ ਹੁੰਦੇ ਹਨ ਠੀਕ ਆ ਇਸ ਇਸ ਪਾਰਟੀਸ਼ਨ ਜਿਹੜੀ ਆ ਇੱਕ ਪਾਰਟੀਸ਼ਨ ਕੀਤੀ ਹੁੰਦੀ ਆ ਜਾਂ ਜਿਹੜੀ ਕਹਿੰਦੇ ਆ ਲਕੀਰ ਮਾਰੀ ਹੁੰਦੀ ਆ ਠੀਕ ਆ ਉਹ ਲਕੀਰ ਲਕੀਰ ਨੂੰ ਹੱਥ ਦੂਜੇ ਜਾਫੀ ਨੂੰ ਹੱਥ ਇੱਕ ਜਣੇ ਨੂੰ ਹੱਥ ਲਾ ਕੇ ਉਸ ਜੋ ਜੋ ਜਗ੍ਹਾ ਦਿੱਤੀ ਹੁੰਦੀ ਹੈ ਉਸ ਵਿੱਚੋਂ ਲੰਘਣਾ ਪੈਂਦਾ ਹੈ ਇਸ ਤਰ੍ਹਾਂ ਉਹਦਾ ਪੁਆਇੰਟ ਵੱਧਦੇ ਹਨ ਜਾਂ ਕਹਿ ਲਉ ਵੀ ਉਹਦਾ ਸਾਹਸ ਵੱਧਦਾ ਹੈ ਠੀਕ ਆ ਇਸ ਵਿੱਚ ਕਬੱਡੀ ਜਦੋਂ ਖੇਡਦੇ ਹਨ ਤਾਂ ਲੋਕ ਉਹਨਾਂ ਦਾ ਮਨੋਰੰਜਨ ਕਰਦੇ ਹਨ ਕਈ ਅਖਾੜੇ ਵੀ ਲਗਾਉਂਦੇ ਹਨ ਠੀਕ ਆ ਅਤੇ ਉਨ੍ਹਾਂ ਦਾ ਆਲੇ ਦੁਆਲੇ ਦੇ ਪਿੰਡਾਂ ਆਉਂਦੇ ਉਹਨਾਂ ਦਾ ਸਾਹਸ ਵਧਾਉਂਦੇ ਹਨ ਅਤੇ ਇਸ ਕਰਕੇ ਕਬੱਡੀ ਆ ਜਿਹੜੀ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਵਿੱਚ ਖੇਡੀ ਜਾਂਦੀ ਹੈ